ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਓਲਾ ਤੋਂ ਬੋਲ ਰਹੇ ਹੋ ਹਾਂਜੀ ਵੀਰ ਜੀ ਮੈਂ ਇੱਕ ਕੈਬ ਬੁੱਕ ਕਰਵਾਉਣੀ ਸੀ ਕੱਲ੍ਹ ਮੇਰਾ ਐਗਜ਼ਾਮ ਹੈ ਅੰਮ੍ਰਿਤਸਰ ਵਿਖੇ ਅਤੇ ਉੱਥੇ ਮੈਂ ਜਾਣਾ ਹੈ ਅਤੇ ਮੈਂ ਕੱਲ੍ਹ ਉਸ ਦੇ ਲਈ ਤੁਹਾਡੀ ਕੈਬ ਬੁੱਕ ਕਰਵਾਉਣੀ ਸੀ ਅਤੇ ਮੈਂ ਅ ਪਠਾਨਕੋਟ ਢਾਂਗੂ ਰੋਡ ਦੀ ਰਹਿਣ ਵਾਲੀ ਹਾਂ ਅਤੇ ਮੇਰਾ ਮਕਾਨ ਜਿਹੜਾ ਹੈਗਾ ਮਹਾਜਨ ਆਈਸ ਫੈਕਟਰੀ ਦੇ ਸਾਹਮਣੇ ਹੈਗਾ ਅਤੇ ਤੁਸੀਂ ਪਲੀਜ਼ ਮੈਨੂੰ ਕੱਲ੍ਹ ਦਸ ਵਜੇ ਪਿੱਕ ਕਰ ਲੈਣਾ ਕਿਉਂਕਿ ਦਸ ਇੱਕ ਤੋਂ ਚਾਰ ਵਜੇ ਤੱਕ ਤਾਂ ਮੇਰਾ ਟਾਈਮ ਹੈਗਾ ਅਤੇ ਇਸ ਕਰਕੇ ਤੁਸੀਂ ਮੈਨੂੰ ਕੱਲ੍ਹ ਪੂਰੇ ਦਸ ਵਜੇ ਪਿੱਕ ਕਰਕੇ ਮੈਨੂੰ ਘਰੋਂ ਪਿੱਕ ਕਰ ਲਿਓ ਅਤੇ ਤੁਸੀਂ ਮੈਨੂੰ ਪਲੀਜ਼ ਐਕਸਪਲੇਨ ਕਰ ਦਿਓ ਅਤੇ ਦੱਸ ਦਿਓ ਕਿ ਤੁਹਾਡੇ ਕੀ ਚਾਰਜਸ ਨੇ ਠੀਕ ਹੈ ਕਿੰਨੇ ਦੀ ਕਿੰਨੇ ਪੈਸੇ ਲੱਗਣਗੇ ਕਾਰ ਬੁੱਕ ਕਰਨ ਦੇ ਅਤੇ ਕੀ ਤੁਸੀਂ ਮੈਨੂੰ ਉੱਥੇ ਸਮੇਂ ਸਿਰ ਪਹੁੰਚਾ ਦਿਓਗੇ ਅਗਰ ਨਹੀਂ ਪਹੁੰਚਾ ਸਕਦੇ ਤਾਂ ਵੀ ਦੱਸ ਦਿਓ ਠੀਕ ਹੈ ਕਿਉਂਕਿ ਮੇਰਾ ਕੱਲ੍ਹ ਐਗਜ਼ਾਮ ਹੈ ਅਤੇ ਮੇਰਾ ਉੱਥੇ ਸਮੇਂ ਸਿਰ ਪਹੁੰਚਣਾ ਬਹੁਤ ਜ਼ਰੂਰੀ ਹੈ ਮੈਂ ਤੁਹਾਨੂੰ ਇੱਕ ਵਾਰ ਫਿਰ ਦੱਸ ਦੇਵਾਂ ਕਿ ਮੇਰਾ ਜਿਹੜਾ ਐਡਰੈਸ ਹੈਗਾ ਉਹ ਗਲੀ ਨੰਬਰ ਤਿੰਨ ਸ਼ਿਵਾਜੀ ਨਗਰ ਔਪੋਜਿਟ ਮਹਾਜਨ ਆਈਸ ਫੈਕਟਰੀ ਢਾਂਗੂ ਰੋਡ ਪਠਾਨਕੋਟ ਵਿਖੇ ਹੈ ਅਤੇ ਪਲੀਜ਼ ਤੁਸੀਂ ਮੈਨੂੰ ਦੱਸ ਦਿਓ ਕਿ ਤੁਸੀਂ ਕਿੰਨੇ ਵਜੇ ਤੱਕ ਮੇਰੇ ਕੋਲ ਰੈਡੀ ਹੋਵੋਗੇ ਅਤੇ ਮੈਨੂੰ ਇਸ ਨੰਬਰ 'ਤੇ ਤੁਸੀਂ ਕੋਨਟੈਕਟ ਕਰ ਲੈਣਾ ਆਉਣ ਤੋਂ ਪਹਿਲਾਂ ਤੇ ਤਾਂ ਜੋ ਮੈਂ ਉੱਥੇ ਸਮੇਂ ਸਿਰ ਪਹੁੰਚ ਸਕਾਂ